ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬੀਆ ਸ਼ਰਮਾ ਹੈ ਬਹੁਤ ਹੀ ਨਿਰਾਸ਼ਾ ਨਾਲ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਕੁਝ ਦਿਨਾਂ ਪਹਿਲਾਂ ਮੈਂ ਤੁਹਾਡੀ ਕੰਪਨੀ ਤੋਂ ਇੱਕ ਮੋਬਾਈਲ ਫੋਨ ਔਰਡਰ ਕੀਤਾ ਸੀ ਜਿਵੇਂ ਜਿਵੇਂ ਤੁਸੀਂ ਦੱਸਿਆ ਸੀ ਕਿਵੇਂ ਡਿਲੀਵਰੀ ਹੋਏਗੀ ਕੀ ਕੀ ਫੀਚਰਜ ਹੋਣਗੇ ਉਸਦੇ ਅਕੋਰਡਿੰਗ ਇੱਕ ਵੀ ਗੱਲ ਮੈਚ ਨਹੀਂ ਹੋਈ ਪਹਿਲੀ ਗੱਲ ਤਾਂ ਤੁਸੀਂ ਕਿਹਾ ਸੀ ਡਿਲੀਵਰੀ ਟਾਈਮ 'ਤੇ ਹੋਵੇਗੀ ਤਾਂ ਡਿਲੀਵਰੀ ਇੱਕ ਹਫਤਾ ਲੇਟ ਹੋਈ ਹੈ ਅਤੇ ਜਿਸ ਕਾਰਨ ਮੈਨੂੰ ਬਹੁਤ ਹੀ ਪਰੇਸ਼ਾਨੀ ਝੱਲਣੀ ਪਈ ਦੂਜੀ ਜੋ ਮੋਬਾਈਲ ਕੰਪਨੀ ਦਾ ਮੈਂ ਔਰਡਰ ਕੀਤਾ ਸੀ ਉਸ ਤੋਂ ਅਲੱਗ ਹੀ ਉਲਟ ਕੰਪਨੀ ਦਾ ਮੋਬਾਈਲ ਮੈਨੂੰ ਡਿਲੀਵਰ ਹੋਇਆ ਹੈ ਅਤੇ ਫੀਚਰਸ ਦੀ ਗੱਲ ਕਰੀਏ ਤਾਂ ਮੋਬਾਈਲ ਫੋਨ ਦੀ ਸਕਰੀਨ ਬਿਲਕੁਲ ਹੀ ਟੁੱਟੀ ਹੋਈ ਹੈ ਸਪੀਕਰ ਹੈ ਉਸ 'ਚ ਪ੍ਰੋਪਰ ਆਵਾਜ਼ ਨਹੀਂ ਆ ਰਹੀ ਚਾਰਜਰ ਜੋ ਤੁਸੀਂ ਦਿੱਤਾ ਹੈ ਉਹ ਵੀ ਪ੍ਰੋਪਰ ਵਰਕ ਨਹੀਂ ਕਰਦਾ ਪਿਆ ਅਤੇ ਮੈਂ ਆਖਰ 'ਚ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਸਿਫਤਾਂ ਕਰਕੇ ਦੱਸਿਆ ਸੀ ਮੈਨੂੰ ਕਿ ਕਿਵੇਂ ਤੁਸੀਂ ਪ੍ਰੋਡਕਟ ਸੇਲ ਕਰਦੇ ਹੋ ਕਿਵੇਂ ਤੁਹਾਡੀ ਕੁਆਲਿਟੀ ਹੁੰਦੀ ਹੈ ਪ੍ਰੋਡਕਟ ਦੀ ਉਸਦੇ ਅਕੋਰਡਿੰਗ ਬਿਲਕੁਲ ਵੀ ਮੈਨੂੰ ਔਰਡਰ ਨਹੀਂ ਮਿਲਿਆ ਹੈ ਮੈਂ ਤਾਂ ਇਹੀ ਉਮੀਦ ਕਰਦੀ ਹਾਂ ਕਿ ਕੋਈ ਵੀ ਤੁਹਾਡੀ ਕੰਪਨੀ 'ਚੋਂ ਔਰਡਰ ਨਾ ਕਰੇ ਤਾਂ ਅੱਗੇ ਵੀ ਮੈਂ ਆਪਣੇ ਦੋਸਤ ਜਾਂ ਫੈਮਲੀ ਕਿਸੇ ਨੂੰ ਵੀ ਰਿਕਮੈਂਡ ਨਹੀਂ ਕਰਾਂਗੀ ਤੁਹਾਡੀ ਕੰਪਨੀ 'ਚੋਂ ਸਮਾਨ ਖਰੀਦਣ ਲਈ